ਲਿਖਣਾ ਮੇਰੀ ਇੱਕ ਰੁਚੀ ਹੈ ਮੈਨੂੰ ਸਮਾਜਿਕ ਕੁਰੀਤੀਆਂ ਔਰਤ ਦੀਆਂ ਦਸ਼ਾ ਸਮਾਜ ਵਿੱਚ ਹੋਣ ਭਰਿਸ਼ਟਾਚਾਰ ਬਾਰੇ ਲਿਖਣਾ ਪੜ੍ਹਨਾ ਅਤੇ ਬੋਲਣਾ ਬਹੁਤ ਪਸੰਦ ਹੈ ਔਰਤ ਦੀ ਦਸ਼ਾ ਜੋ ਇਹ ਆ ਸਮਾਜ ਮਨੂ ਸਮਾਜ ਮਨੁੱਖ ਸਮਿਤੀਆਂ ਅਤੇ ਮੁਗਲਾਂ ਦੇ ਦੇ ਸਮੇਂ ਤੋਂ ਹੋਣ ਵਾਲੀ ਬੁਰੀ ਹਾਲਤ ਬਾਰੇ ਹਰ ਇੱਕ ਪੰਜਾਬੀ ਲੇਖਕ ਬਹੁਤ ਕੁਝ ਲਿਖਿਆ ਭਾਵੇਂ ਹੁਣ ਬਹੁਤ ਸਮਾਂ ਬੀਤ ਚੁੱਕਿਆ ਪਰ ਔਰਤ ਦੀ ਦਸ਼ਾ 'ਚ ਕੋਈ ਸੁਧਾਰ ਜ਼ਿਆਦਾ ਸੁਧਾਰ ਨਹੀਂ ਹੋਇਆ ਅੱਤਿਆਚਾਰ ਦਾ ਤਰੀਕਾ ਬਦਲ ਗਿਆ ਹੈ ਇੱਕ ਪੁਰਸ਼ ਔਰਤ ਦੇ ਬਾਰੇ ਇੰਨੀ ਚੰਗੀ ਤਰ੍ਹਾਂ ਨਹੀਂ ਦੱਸ ਸਕਦਾ ਜਿੰਨਾ ਇੱਕ ਔਰਤ ਲੇਖਕ ਔਰਤ ਦੀ ਦਸ਼ਾ ਨੂੰ ਪ੍ਰਗਟਾਵਾ ਕਰ ਸਕਦੀ ਹੈ ਤਕਲੀਫ ਨੂੰ ਬਿਆਨ ਕਰ ਸਕਦੀ ਹੈ ਪੰਜਾਬੀ ਸਾਹਿਤ ਵਿੱਚ ਇਸਤਰੀਆਂ ਲੇਖਕਾਂ ਦਾ ਬਹੁਤ ਯੋਗਦਾਨ ਹੈ ਸਭ ਤੋਂ ਵੱਧ ਅਮ੍ਰਿਤਾ ਪ੍ਰੀਤਮ ਅਤੇ ਹੋਰ ਲੇਖਿਕਾ ਦਲੀਪ ਕੌਰ ਰੂਪਾ ਬਾਜਵਾ ਸੋਨਮ ਭਾਟੀਆ ਇਹਨਾਂ ਦੀ ਲਿਖਤਾਂ ਪੜ੍ਹ ਕੇ ਅ ਅਮ ਅ ਅਸਲ ਵਿੱਚ ਔਰਤਾਂ ਪ੍ਰਤੀ ਮਰਦ ਸਮਾਜ ਦਾ ਦ੍ਰਿਸ਼ਟੀਕੋਣ ਬਾਰੇ ਪਤਾ ਲੱਗਦਾ ਹੈ ਇਹ ਸਫ਼ਲ ਔਰਤ ਨੂੰ ਸਫ਼ਲ ਹੋਣ ਲਈ ਕੀ ਕੀ ਦੇਖਣਾ ਪੈਂਦਾ ਹੈ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅੰਮ੍ਰਿਤਾ ਪ੍ਰੀਤਮ ਪੂਰੇ ਸੰਸਾਰ ਵਿੱਚ ਆਪਣੀਆਂ ਰਚਨਾਵਾਂ ਕਰਕੇ ਪ੍ਰਸਿੱਧ ਹੈ ਇਸ ਇਹਨਾਂ ਇਹ ਅੰਮ੍ਰਿਤਾ ਪ੍ਰੀਤਮ ਜੀ ਨੇ ਆਪਣੇ ਪੂਰੇ ਜੀਵਨ ਕਾਲ ਵਿੱਚ ਔਰਤਾਂ ਦੇ ਪ੍ਰਤੀ ਔਰਤਾਂ ਨੂੰ ਜਾਗਰੂਕ ਕਰਨ ਲਈ ਅਤੇ ਔਰਤਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਹੈ ਜਿਸ ਨਾਲ ਕਿ ਔਰਤਾਂ ਦੇ ਹਲਾਤ ਦੇ ਵਿੱਚ ਸੁਧਾਰ ਆ ਸਕੇ